ਯੋਗ ਅਭਿਆਸ ਦੇ ਵਿੱਚ ਧਿਆਨ ਦੀ ਬਹੁਤ ਹੀ ਜ਼ਿਆਦਾ ਅਹਿਮ ਭੂਮਿਕਾ ਹੈ ਮੈਡੀਟੇਸ਼ਨ ਕਰਨ ਦੇ ਵੇਲੇ ਯੋਗ ਕਰਨ ਦੇ ਵੇਲੇ ਸਾਨੂੰ ਧਿਆਨ ਲਗਾਉਣਾ ਇੱਕ ਜਗ੍ਹਾ ਬਹੁਤ ਹੀ ਜ਼ਰੂਰੀ ਹੁੰਦਾ ਅਗਰ ਆਪਾਂ ਇਸ ਚੀਜ਼ 'ਚ ਮਾਹਿਰ ਹੋ ਜਾਂਦੇ ਹਾਂ ਤਾਂ ਆਪਾਂ ਆਪਣੇ ਜ਼ਿੰਦਗੀ ਦੇ ਵਿੱਚ ਹੋਰ ਵੀ ਸਾਰੇ ਕੰਮ ਕਰਨ ਦੇ ਵਿੱਚ ਮਾਹਿਰ ਹੋ ਜਾਂਦੇ ਹਾਂ ਅਗਰ ਅਸੀਂ ਆਪਣਾ ਧਿਆਨ ਇੱਕ ਜਗ੍ਹਾ 'ਤੇ ਲੰਬੇ ਸਮੇਂ ਤੱਕ ਇਕੱਤਰਿਤ ਕਰਕੇ ਸ਼ਾਂਤ ਤਰੀਕੇ ਨਾਲ ਮੈਡੀਟੇਟ ਕਰ ਸਕਦੇ ਹਾਂ ਇਸ ਨਾਲ ਸਾਨੂੰ ਕਾਫੀ ਮਦਦ ਮਿਲਦੀ ਹੈ ਆਪਾਂ ਆਪਣੀ ਜ਼ਿੰਦਗੀ ਦੇ ਹੋਰ ਕੰਮਾਂ ਦੇ ਵਿੱਚ ਵੀ ਇਸੇ ਤਰ੍ਹਾਂ ਧਿਆਨ ਅਤੇ ਫੋਕਸ ਲਗਾ ਸਕਦੇ ਹਾਂ ਅਗਰ ਆਪਾਂ ਇਸ ਤਰ੍ਹਾਂ ਆਪਣੇ ਧਿਆਨ ਨੂੰ ਇੱਕ ਜਗ੍ਹਾ ਇਕੱਤਰਿਤ ਕਰਕੇ ਮੈਡੀਟੇਟ ਕਰਨਾ ਸਿੱਖਦੇ ਹਾਂ ਤਾਂ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਕਾਫੀ ਸਾਰੇ ਨੈਗੇਟਿਵ ਅਤੇ ਪੋਜੀਟਿਵ ਚੀਜ਼ਾਂ ਦੇ ਉੱਤੇ ਵੀ ਪਤਾ ਲੱਗਦਾ ਹੈ ਅਗਰ ਆਪਾਂ ਆਪਣੀਆਂ ਨੈਗੇਟਿਵ ਅਤੇ ਪੋਜੀਟਿਵ ਚੀਜ਼ਾਂ ਦੇ ਬਾਰੇ ਜਾਣਦੇ ਹਾਂ ਤਾਂ ਆਪਾਂ ਆਪਣੇ ਜੀਵਨ ਨੂੰ ਹੋਰ ਵੀ ਜ਼ਿਆਦਾ ਅੱਗੇ ਸਫਲ ਬਣਾ ਸਕਦੇ ਹਾਂ ਅਗਰ ਆਪਾਂ ਆਪਣੀਆਂ ਨੈਗੇਟਿਵ ਚੀਜ਼ਾਂ ਨੂੰ ਸੁਧਾਰ ਕੇ ਪੋਜੀਟਿਵ ਵੱਲ ਲੈ ਕੇ ਜਾਂਦੇ ਹਾਂ ਅਤੇ ਪੋਜੀਟਿਵ ਚੀਜ਼ਾਂ ਨੂੰ ਹੋਰ ਵੀ ਜ਼ਿਆਦਾ ਅੱਗੇ ਲੈ ਕੇ ਜਾਂਦੇ ਹਾਂ ਆਪਣੇ ਧਿਆਨ ਦੇ ਨਾਲ ਆਪਣੇ ਫੋਕਸ ਦੇ ਨਾਲ ਇਹਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਬਹੁਤ ਹੀ ਮਦਦ ਮਿਲਦੀ ਹੈ ਸਾਡੇ ਜ਼ਿੰਦਗੀ ਦੇ ਵਿੱਚ ਯੋਗ ਦੇ ਵਿੱਚ ਧਿਆਨ ਦਾ ਬਹੁਤ ਹੀ ਮਹੱਤਵਪੂਰਨ ਅੰਗ ਹੈ